ਪੰਜਾਬੀ ਭਾਸ਼ਾ ਦੀ ਜਿਹੜੀ ਵਰਤੋਂ ਹੈ ਸਥਾਨਕ ਆਰਥਿਕਤਾ ਵਿੱਚ ਤਾਂ ਬਿਲਕੁਲ ਵੀ ਕਿਤੇ ਮੈਨੂੰ ਲੱਗਦਾ ਨਹੀਂ ਕੋਈ ਯੋਗਦਾਨ ਪਾਈ ਜਾ ਰਹੀ ਪਾਇਆ ਜਾ ਰਿਹਾ ਇਹਦਾ ਹਾਂ ਇੱਕ ਜਿਹੜਾ ਪੰਜਾਬ ਸਰਕਾਰ ਵੱਲੋਂ ਕਾਨੂੰਨ ਚਲਾਇਆ ਸੀ ਕਿ ਪੰਜਾਬ ਦੇ ਜਿਹੜੇ ਕਿਤੇ ਵੀ ਜਿਹੜੇ ਨੋਟਿਸ ਬੋਰਡ ਹੈ ਜਾਂ ਕੋਈ ਵੀ ਬੋਰਡ ਹੈ ਕਿਸੇ ਤਰ੍ਹਾਂ ਦੀ ਫਲੈਕਸ ਬੋਰਡ ਹੈ ਤਾਂ ਜਿਹੜੇ ਉਹਦੇ ਪੰਜਾਬੀ ਵਿੱਚ ਵੀ ਛਪਵਾਏ ਜਾਣ ਤਾਂ ਸਿਰਫ਼ ਉਹਦੀ ਇਹ ਹੀ ਆਰਥਿਕਤਾ ਹੈ ਕਿ ਜਿਹੜੇ ਮਤਲਬ ਜਿ ਜਿਹਨਾਂ ਨੂੰ ਇਹ ਜਾ ਰਿਹਾ ਹੈ ਕੰਮ ਤਾਂ ਉਹਨਾਂ ਨੂੰ ਇਹ ਹੈ ਕਿ ਪੰਜਾਬੀ ਵਿੱਚ ਵੀ ਐਕਸਟ੍ਰਾ ਲਿਖ ਕੇ ਥੋੜ੍ਹਾ ਬਹੁਤਾ ਜਿਹੜੀ ਲੌਕਲ ਆਰਥਿਕਤਾ ਉਹਦੇ ਵਿੱਚ ਜਿਹੜਾ ਯੋਗਦਾਨ ਪਿਆ ਹੈ ਪਰ ਉਹ ਵੀ ਬਸ ਨਾ ਮਾਤਰ ਹੀ ਹੈ ਅਤੇ ਹੋਰ ਜੇ ਦੇਖਿਆ ਜਾਵੇ ਤਾਂ ਕਿਤੇ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਅਤੇ ਜਿਵੇਂ ਵਪਾਰ ਵਣਜ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇੱਥੇ ਤਾਂ ਬਿਲਕੁਲ ਹੀ ਨਹੀਂ ਹੈ ਇੱਥੇ ਤਾਂ ਪੰਜਾਬੀ ਭਾਸ਼ਾ ਦੇ ਜਿਹੜੇ ਦੇ ਜਿਹੜੇ ਵਪਾਰ ਔਰ ਵਣਜ ਵਿੱਚ ਵਰਤੇ ਜਾਣ ਵਾਲੇ ਸ਼ਬਦ ਹੈ ਉਹ ਵੀ ਲੋਕਾਂ ਨੂੰ ਨਹੀਂ ਪਤਾ ਹੋਣਗੇ ਕਿ ਇਹਨਾਂ ਨੂੰ ਪੰਜਾਬੀ ਵਿੱਚ ਕਿਹਾ ਕੀ ਜਾਂਦਾ ਹੈ ਅਤੇ ਉਹਦੀ ਵਰਤੋਂ ਤਾਂ ਦੂਰ ਦੀ ਗੱਲ ਹੈ ਕਿ ਬਿਜ਼ਨੈੱਸ ਵਿੱਚ ਕੀਤੀ ਜਾ ਸਕਦੀ ਹੈ ਅਤੇ ਪੰਜਾਬੀ ਮਤਲਬ ਤਾਂ ਹੁਣ ਸਕੂਲਾਂ ਕਾਲਜਾਂ ਵਿੱਚ ਰਹਿ ਗਈ ਹੈ ਨੋਟਿਸ ਬੋਰਡਾਂ 'ਤੇ ਰਹਿ ਗਈ ਹੈ ਜਾਂ ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਰਹਿ ਗਈ ਹੈ ਅਤੇ ਪੰਜਾਬੀ ਦੇ ਜਿਹੜੇ ਪੰਜਾਬ ਵਿੱਚ ਪ੍ਰਾਈਵੇਟ ਸਕੂਲ ਵੀ ਹੈ ਉਹ ਵੀ ਉੱਥੇ ਵੀ ਪੰਜਾਬੀ ਆਪਸ਼ਨਲ ਹੈ ਮੈਨਡੇਟਰੀ ਨਹੀਂ ਹੈ ਅਤੇ ਇਸ ਤਰ੍ਹਾਂ ਵੀ ਪੰਜਾਬੀ ਭਾਸ਼ਾ ਤਾਂ ਜਿਹੜੀ ਪੰਜਾਬ 'ਚੋਂ ਤਾਂ ਅਲੋਪ ਹੀ ਹੋ ਗਈ ਹੈ ਇਹਦੀ ਸਿਰਫ਼ ਇਹਦੀ ਹੋਂਦ ਹੀ ਰੱਖਣਾ ਬਹੁਤ ਜ਼ਰੂਰੀ ਹੋ ਗਈ ਹੈ ਇਹਦੀ ਸਥਾਨਕ ਆਰਥਿਕਤਾ ਵਿੱਚ ਤਾਂ ਕੀ ਇਹਦੀ ਆਪਾਂ ਵਰਤੋਂ ਕਰ ਸਕਦੇ ਹਾਂ